ਭੰਗੜਾ ਪੰਜਾਬ ਦਾ ਬਹੁਤ ਹੀ ਮਹੱਤਵਪੂਰਨ ਹਿੱਸਾ ਹੈ ਭੰਗੜਾ ਬਹੁਤ ਸਾਰੇ ਜ਼ਿਲ੍ਹਿਆਂ ਵਿੱਚ ਪਾਇਆ ਜਾਂਦਾ ਹੈ ਜਦੋਂ ਕਣਕ ਦੀ ਵਾਢੀ ਹੁੰਦੀ ਹੈ ਉਸ ਟੈਮ ਏ ਪਾਇਆ ਉਸ ਸਮੇਂ ਪਾਇਆ ਜਾਂਦਾ ਹੈ ਇਸ ਵਿੱਚ ਬਹੁਤ ਸਾਰੇ ਸਾਜਾਂ ਦੀ ਵਰਤੋਂ ਕੀਤੀ ਜਾਂਦੀ ਜਾਂਦੀ ਹੈ ਅਲਗੋਜ਼ੇ ਸੱਪ ਕਾਟੋ ਭੰਗੜੇ ਵਿੱਚ ਢੋਲੀ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ਇਸ ਵਿੱਚ ਮੋ ਉੱਪਰ ਨੂੰ ਮੋਢੇ ਹਿਲਾਉਂਦੇ ਹਨ ਇਸ ਵਿੱਚ ਚਾਦਰਾ ਕੁੜਤਾ ਪੱਗ ਅਤੇ ਹੱਥਾਂ ਦੇ ਵਿੱਚ ਆਕਰਸ਼ਣ ਕਰਨ ਲਈ ਗਹਿਣੇ ਪਾਏ ਜਾਂਦੇ ਹਨ ਗੱਲ ਦੇ ਵਿੱਚ ਕੈਂਠਾ ਪਾਇਆ ਜਾਂਦਾ ਹੈ ਅਤੇ ਬਹੁਤ ਹੀ ਭੜਕੀਲੇ ਰੰਗ ਦੇ ਕੱਪੜੇ ਪਾਏ ਜਾਂਦੇ ਹਨ ਜਿਸ ਨਾਲ ਕਿ ਲੋਕਾਂ ਨੂੰ ਆਕਰਸ਼ਿਤ ਕੀਤਾ ਜਾਂਦਾ ਹੈ ਇਸ ਵਿੱਚ ਅਸੀਂ ਦੱਸ ਸਕਦੇ ਹਾਂ ਕਿ ਭੰਗੜੇ ਵਾਲੇ ਮੁੰਡੇ ਜਾਂ ਕੁੜੀਆਂ ਛੜੱਪੇ ਮਾਰਦੇ ਹਨ ਜਿਸ ਨਾਲ ਕਿ ਲੋਕ ਉਹਨਾਂ ਨੂੰ ਦੇਖਣ ਲਈ ਉਤਸ਼ਾਹਿਤ ਹੁੰਦੇ ਹਨ ਇਸ ਵਿੱਚ ਅਸੀਂ ਦੱਸ ਸਕਦੇ ਹਾਂ ਕਿ ਇਸ ਦੀ ਧਮਾਲ ਪੂਰੇ ਵਿਹੜੇ ਵਿੱਚ ਪੈਂਦੀ ਹੈ ਛੈਲ ਛਬੀਲੇ ਗੱਭਰੂ ਇਸ ਕੰਮ ਨੂੰ ਕਰਦੇ ਹਨ ਇਸ ਵਿੱਚ ਜਵਾਨੀ ਨਾਲ ਜੋਸ਼ ਭਰਿਆ ਹੁੰਦਾ ਹੈ ਭੰਗੜੇ ਵਾਲੇ ਪ੍ਰਦਰਸ਼ਨ ਕਰਨ ਲਈ ਸਟੇਜ ਉੱਪਰ ਚੜ੍ਹਦੇ ਹਨ ਜਾਂ ਫਿਰ ਕਿਸੇ ਵੀ ਵਿਆਹ ਜਾਂ ਤਿਉਹਾਰ ਦੇ ਉੱਪਰ ਭੰਗੜਾ ਪਾਉਂਦੇ ਹਨ ਲੋਹੜੀ ਦੀਵਾਲੀ ਵਿਸਾਖੀ ਦੇ ਉੱਪਰ ਆਮ ਤੌਰ 'ਤੇ ਭੰਗੜਾ ਪਾਇਆ ਜਾਂਦਾ ਹੈ ਭੰਗੜਾ ਪਾਉਣ ਲਈ ਨਾਚ ਸੰਬੰਧੀ ਵਿਸਾਖੀ ਦੇ ਸਮੇਂ ਜਦੋਂ ਕਣਕ ਦੀ ਵਾਢੀ ਨਾਲ ਹੈ ਤਾਂ ਉਸ ਸਮੇਂ ਬੜੇ ਹੀ ਸੋਹਣੇ ਤਰੀਕੇ ਨਾਲ ਭੰਗੜਾ ਪਾਇਆ ਜਾਂਦਾ ਹੈ ਭੰਗੜਾ ਪੰਜਾਬੀਆਂ ਦਾ ਪ੍ਰਸਿੱਧ ਨਾਚ ਹੈ ਇਸ ਸਮੇਂ ਬਹੁਤ ਸਾਰੀਆਂ ਸੋਹਣੀਆਂ ਸੋਹਣੀਆਂ ਪੋਸ਼ਾਕਾਂ ਪਹਿਨੀਆਂ ਜਾਂਦੀਆਂ ਹਨ ਅਤੇ ਬਹੁਤ ਹੀ ਸੋਹਣੇ ਤਰੀਕੇ ਨਾਲ ਕੰਮ ਕੀਤਾ ਜਾਂਦਾ ਹੈ ਇਸ ਤਰ੍ਹਾਂ ਹੀ ਅਸੀਂ ਕਹਿ ਸਕਦੇ ਹਾਂ ਕਿ ਭੰਗੜਾ ਬੜੀ ਹੀ ਜਗ੍ਹਾ ਪ੍ਰਚਲਿਤ ਹੈ ਅਤੇ ਭੰਗੜੇ ਵਿੱਚ ਬਹੁਤ ਸਾਰੇ ਹੱਥਾਂ ਕੰਨਾਂ ਸਿਰ ਗਲੇ ਅਤੇ ਪੈਰਾਂ ਦੇ ਵਿੱਚ ਗਹਿਣੇ ਪਾਏ ਜਾਂਦੇ ਹਨ ਧੰਨਵਾਦ